ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਭਾਅ ਜੀ ਅਪ ਸਾਡੇ ਨਾ ਇੱਕ ਕੋਲੇਜ 'ਚ ਪ੍ਰੋਗਰਾਮ ਹੈਗਾ ਆਪਾਂ ਇੱਕ ਪਾਰਟੀ ਰੱਖੀ ਆ ਅਤੇ ਉਹਦੇ ਵਾਸਤੇ ਸਾਨੂੰ ਮਠਿਆਈ ਚਾਹੀਦੀ ਆ ਅਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਹ ਮਠਿਆਈ ਸਾਨੂੰ ਮਿਲ ਜਾਵੇਗੀ ਜਿਸ ਤਰ੍ਹਾਂ ਕਿ ਆਪਾਂ ਨੂੰ ਕੁਛ ਬਰਫੀ ਦੇ ਕੁਛ ਕੁ ਕਿੱਲੋ ਬਰਫੀ ਚਾਹੀਦੀ ਆ ਕੁ ਗੁਲਾਬ ਜਾਮਣ ਹੋ ਜਾਣ ਅਤੇ ਕੁਝ ਰਸਗੁੱਲੇ ਹੋ ਜਾਣ ਅਤੇ ਹੋਰ ਇੱਕ ਦੋ ਸਮਝ ਲਓ ਵੀ ਹੋਰ ਚੀਜ਼ਾਂ ਚਾਹੀਦੀਆਂ ਕੋਈ ਮੀ ਮੱਠੀਆਂ ਮੁੱਠੀਆਂ ਹੋ ਜਾਣ ਨਮਕੀਨ ਦੇ ਵਿੱਚ ਅਤੇ ਇਹ ਜਿਹੜਾ ਸਾਰਾ ਸਾਨੂੰ ਸਮਾਨ ਹੈ ਆਪਣਾ ਪੱਚੀ ਕੁ ਤਰੀਕ ਤੱਕ ਮਿਲ ਜਾਵੇਗਾ ਅਤੇ ਇਹਨਾਂ ਦਾ ਫਿਰ ਰੇਟ ਕੀ ਕੀ ਹੋਏਗਾ ਆਪਣਾ ਕਿਸ ਤਰ੍ਹਾਂ ਲਗਾਓਗੇ ਹਾਂਜੀ ਅਤੇ ਅੱਛਾ ਬਰਫੀ ਇਸ ਭਾਅ ਠੀਕ ਆ ਅਤੇ ਗੁਲਾਬ ਜਾਮਣਾਂ ਜੀ ਅਤੇ ਰਸਗੁੱਲੇ ਮੱਠੀ ਜੀ ਠੀਕ ਆ ਜੀ ਅਤੇ ਇਹ ਕਦੋਂ ਕੁ ਤੱਕ ਸਾਨੂੰ ਮਿਲ ਜਾਣਗੇ ਜੀ ਅੱਛਾ ਠੀਕ ਹੈ ਤਿਆਰ ਕਰ ਦਿਉ ਚਲੋ ਠੀਕ ਹੈ ਜੀ ਫਿਰ ਅਸੀਂ ਤੁਹਾਨੂੰ ਦੱਸਦੇ ਹਾਂ